ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਅਰਸ਼ ਗੱਲ ਕਰ ਰਹੇ ਹੋ ਹਾਂਜੀ ਮੈਂ ਸੁਮਨ ਬੋਲ ਰਹੀ ਹਾਂ ਤੁਹਾਡੇ ਗਵਾਂਡ 'ਚੋਂ ਹੀ ਹਾਂਜੀ ਮੈਂ ਨਾ ਇੱਦਾਂ ਪਤਾ ਕਰਨਾ ਸੀਗਾ ਤਾਜ਼ੀ ਸਬਜ਼ੀ ਕਿੱਥੋਂ ਮਿਲਦੀ ਹੈ ਹਾਂਜੀ ਹਾਂਜੀ ਬਸ ਸਟੈਂਡ ਪਤਾ ਹੈ ਜੀ ਅੱਛਾ ਜੀ ਅੱਛਾ ਜੀ ਅੱਛਾ ਠੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਨਾ ਮੈਂ ਹਾਂਜੀ ਆਪਣੇ ਜਿਹੜੇ ਹਾਂਜੀ ਹਾਂਜੀ ਉਹ ਮੈਂ ਨਾ ਕੱਲ੍ਹ ਇਹਨਾਂ ਤੋਂ ਲਈ ਸੀ ਜਿਹੜੇ ਆਪਣੇ ਰੇਹੜੀ ਵਾਲੇ ਨਹੀਂ ਆਉਂਦੇ ਅਤੇ ਉਹ ਹਾਂਜੀ ਉਹ ਸਬਜ਼ੀ ਨਾ ਇੰਨੀ ਜ਼ਿਆਦਾ ਵਧੀਆ ਨਹੀਂ ਸੀ ਬਾਸੀ ਸਬਜ਼ੀ ਸੀ ਓਹ ਮੈਨੂੰ ਵਧੀਆ ਨਹੀਂ ਲੱਗੀ ਹਾਂਜੀ ਅਤੇ ਤਾਂ ਮੈਨੂੰ ਇੱਦਾਂ ਵੀ ਲੱਗਿਆ ਕਿ ਸ਼ਾਇਦ ਮਹਿੰਗੀ ਵੀ ਲਗਾਉਂਦੇ ਨੇ

ਹਾਂਜੀ ਹਾਂਜੀ ਮੈਨੂੰ ਪਤਾ ਨਹੀਂ ਸੀ ਫਿਰ ਮੈਂ ਸੋਚਿਆ ਚਲੋ ਤੁਹਾਡੇ ਤੋਂ ਪੁੱਛਦੀ ਆਂ ਗੀ ਅਤੇ ਅੱਛਾ ਜੀ

ਠੀਕ ਹੈ ਜੀ ਠੀਕ ਹੈ ਅੱਛਾ ਅੱਛਾ ਠੀਕ ਹੈ ਜੀ ਜੇ ਤੁਸੀਂ ਫ੍ਰੀ ਹੋ ਤਾਂ ਤੁਸੀਂ ਮੇਰੇ ਨਾਲ ਜਾ ਸਕਦੇ ਹੋ ਇੱਕ ਵਾਰ ਹਾਂ ਬਸ ਸ਼ਾਮ ਨੂੰ ਚਲਦੇ ਆ ਫਿਰ ਹਾਂਜੀ ਠੀਕ ਹੈ ਚਲੋ ਮੈਂ ਕੋਲ ਕਰਦੀ ਆ ਫਿਰ ਤੁਹਾਨੂੰ ਸ਼ਾਮ ਨੂੰ ਠੀਕ ਹੈ ਜੀ ਓਕੇ